ਮੋਬਾਈਲ ਅਤੇ ਟੀਵੀ ਦੀ ਵਰਤੋਂ ਕਰਨ ਜ਼ਿਆਦਾ ਵਰਤੋਂ ਕਰਨ ਨਾਲ ਹਨਾ ਮਤਲਬ ਕਿ ਨਿਆਣੇ ਅਤੇ ਮਤਲਬ ਉਤੇ ਮ ਸਰੀਰਕ ਤੌਰ 'ਤੇ ਵੀ ਕਾਫੀ ਪ੍ਰਭਾਵ ਪੈਂਦਾ ਜਿਵੇਂ ਉਹ ਖਾਣਾ ਪੀਣਾ ਘੱਟ ਕਰ ਦਿੰਦੇ ਖਾਣਾ ਪੀਣਾ ਭੁੱਲ ਜਾਂਦੇ ਆ ਟੀਵੀ ਦੇ ਵਿੱਚ ਟੀਵੀ ਦੇਖੇ ਜਾਣਾ ਮਤਲਬ ਸਾਰਾ ਟਾਈਮ ਹੋਰ ਕੋਈ ਕੰਮ ਨੀ ਕਰਨਾ ਟੀਵੀ ਦੇ ਵਿੱਚ ਰਹਿਣਾ ਮਤਲਬ ਉਹਨਾਂ ਦੇ ਮਤਲਬ ਸਰੀਰ ਵਗੈਰਾ ਵੀਕ ਵੀਕ ਹੋਣ ਲੱਗ ਜਿਹਦੇ ਕਰਕੇ ਉਹਨਾਂ ਨੂੰ ਹਰ ਅਲੱਗ ਅਲਗ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਨਿਆਣਿਆਂ 'ਤੇ ਹਨਾ ਮਤਲਬ ਕਿ ਮਾਇ ਮਾਨਸਿਕ ਤੌਰ ਅਤੇ ਮਤਲਬ ਕਿ ਉਹਦੇ 'ਚ ਦ ਮਾਈਗਰੇਨ ਵਗੈਰਾ ਹੋਣਾ ਜਾਂ ਕਈ ਬੱਚੇ ਡਿਪਰੈਸ਼ਨ 'ਚ ਚਲੇ ਜਾਂਦੇ ਆ ਜਿਹਦੇ ਕਰਕੇ ਟੀ ਮੋਬਾਈਲ ਕਰਕੇ ਮੈਂ ਮੋਬਾਈਲ ਔਰ ਟੀਵੀ ਦੇਖਣ ਲਈ ਜ਼ਿਆਦਾ ਕਿ ਉਹਦੇ ਵਿੱਚ ਡਿਪਰੈਸ਼ਨ 'ਚ ਚਲੇ ਜਾਂਦੇ ਡਿਪਰੈਸ਼ਨ ਤੋਂ ਬਾਅਦ ਫਿਰ ਉਹਨੂੰ ਅੱਗੇ ਜਿਹੜਾ ਉਹਨਾਂ ਦਾ ਸਰਵਾਈਵ ਕਰਨਾ ਔਖਾ ਹੋ ਜਾਂਦਾ ਜਿਵੇਂ ਸਟੱਡੀ ਵਗੈਰਾ ਕਰਨਾ ਔਖਾ ਹੋ ਜਾਂਦਾ ਅਤੇ ਕਾਫੀ ਤਰ੍ਹਾਂ ਦੀ ਬਿਮਾਰੀਆਂ ਉਹਨਾਂ ਨੂੰ ਹਨਾ ਮਤਲਬ ਕਿ ਉਹ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਟੀਵੀ ਕਰਕੇ ਅਤੇ ਕਈ ਨਿਆਣੇ ਮਤਲਬ ਜਿਆਦਾ ਹੀ ਜਿੱਦ ਕਰਦੇ ਕੀ ਹਾਂ ਮਤਲਬ ਮੈਂ ਟੀਵੀ ਵਗੈਰਾ ਹੀ ਦੇਖਣਾ ਅਤੇ ਟੀਵੀ ਅਤੇ ਮੋਬਾਈਲ ਨਾਲ ਜ਼ਿਆਦਾ ਉਹਨਾਂ ਦੇ ਮਤਲਬ ਕਿ ਕਈਆਂ ਦੀਆਂ ਅੱਖਾਂ ਵਗੈਰਾ ਵੀ ਅੱਖਾਂ ਦੀ ਜਿਹੜੀ ਰੋਸ਼ਨੀ ਹੁੰਦੀ ਆ ਉਹ ਵੀ ਮਤਲਬ ਵੀਕ ਹੋ ਜਾਂਦੀ ਆ ਅਤੇ ਕਾਫੀ ਤਰ੍ਹਾਂ ਦੇ ਮਤਲਬ ਕਿ ਬਿਮਾਰੀਆਂ ਮਤਲਬ ਇਸ ਚੀਜ਼ ਕਰਕੇ ਵੀ ਹੋ ਜਾਂਦੀਆਂ ਟੀਵੀ ਵਗੈਰਾ ਜਾਂ ਫੋਨ ਵਗੈਰਾ ਦੇਖਣ ਨਾਲ